ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਦੂਜੇ ਦੇਸ਼ ਹਨ ਅਤੇ ਸਾਡਾ ਭਾਰਤ ਦੇਸ਼ ਹੈ ਉਹਦੇ ਵਿੱਚ ਸਿਹਤ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹ ਬਹੁਤ ਹੀ ਫਰਕ ਨੇ ਜਿਵੇਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੀਆਂ ਸੁਵਿਧਾ ਦਿੱਤੀਆਂ ਜਾਂਦੀਆਂ ਨੇ ਉੱਥੇ ਬਹੁਤ ਵਧੀਆ ਮੈਡੀਕਲ ਚੈੱਕਅਪ ਕੀਤੇ ਜਾਂਦੇ ਨੇ ਹਰ ਸਾਲ ਬਾਅਦ ਸਾਰਿਆਂ ਦੀ ਫੁੱਲ ਬੋਡੀ ਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਬਟ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੈ ਨਾ ਤਾਂ ਇੱਥੇ ਕਿਸੇ ਨੂੰ ਪਰੋਪਰਲੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਨਾ ਹੀ ਇੱਥੇ ਕਿਸੇ ਦਾ ਚੰਗੀ ਤਰ੍ਹਾਂ ਮ ਮੈਡੀਕਲ ਟੈਸਟ ਮਤਲਵ ਕਿ ਬਲੱਡ ਟੈਸਟ ਵਗੈਰਾ ਕੁਛ ਵੀ ਕੋਈ ਚੈੱਕਅਪ ਨਹੀਂ ਕੀਤਾ ਜਾਂਦਾ ਇਵਨ ਕਿ ਨਾ ਹੀ ਕੋਈ ਇੱਥੇ ਮੁਫਤ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜੇ ਕੋਈ ਸੱਠ ਸਾਲ ਤੋਂ ਉੱਪਰ ਦਾ ਹੋ ਜਾਂਦਾ ਹੈ ਤਾਂ ਉੱਥੇ ਹਰੇਕ ਸੱਠ ਸਾਲ ਤੋਂ ਉੱਪਰ ਦੇ ਬਜ਼ੁਰਗ ਨੂੰ ਹਰ ਸਾਲ ਬਾਅਦ ਫ੍ਰੀ ਮੈਡੀਕਲ ਚੈੱਕਅਪ ਕਰਵਾਇਆ ਜਾਂਦਾ ਬਟ ਸਾਡੇ ਇੱਥੇ ਐਵੇਂ ਦਾ ਕੁਛ ਨਹੀਂ ਹੁੰਦਾ ਹੈਗਾ ਅਤੇ ਮੈਂ ਚਾਹਵਾਂਗੀ ਕਿ ਆਪਣੇ ਦੇਸ਼ ਦੇ ਵਿੱਚ ਮੇਰੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਵੀ ਇਹ ਜਿਹੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣ ਤਾਂ ਕਿ ਜਿਹੜੇ ਸਾਡੇ ਬਜ਼ੁਰਗ ਹਨ ਉਹ ਵੀ ਆਪਣੀ ਸਿਹਤ ਬਾਰੇ ਜਾਣਕਾਰੀ ਰੱਖ ਸਕਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਧੰਨਵਾਦ